ਹੈਲੋ ਹਾਂਜੀ ਜਗਦੀਪ ਸਿੰਘ ਜੀ ਹਾਂਜੀ ਸਾਹਿਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਬੋਲ ਰਹੇ ਜੀ ਹਾਂਜੀ ਸਾਹਿਬ ਮੈਂ ਵਿਜ਼ਨ ਪੰਜਾਬ ਟੀ ਵੀ ਚੈਨਲ ਤੋਂ ਬੋਲ ਰਿਹਾ ਜੀ ਹਾਂਜੀ ਸਾਹਿਬ ਮੈਂ ਹਰਦੀਪ ਸਿੰਘ ਗਹੂਣ ਬੋਲ ਰਿਹਾ ਜੀ ਹਾਂਜੀ ਸਾਹਿਬ ਮੈਂ ਥੋੜ੍ਹੀ ਜਾਣਕਾਰੀ ਚਾਹੀਦੀ ਸੀਗੀ ਅਸੀਂ ਤੁਹਾਡੇ ਜ਼ਿਲ੍ਹੇ ਦੀ ਨਾ ਡਿਵੈਲਪਮੈਂਟ ਦੇ ਉੱਤੇ ਇੱਕ ਰਿਪੋਰਟ ਕਵਰ ਕਰਨਾ ਚਾਹੁੰਦੇ ਹਾਂ ਅਸੀਂ ਪੰਜਾਬ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੀ ਕਰ ਰਹੇ ਹਾਂ ਇਸ ਤਰ੍ਹਾਂ ਤੁਹਾਡੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੀ ਵੀ ਕਰਦੇ ਮੈਨੂੰ ਜਾਣਕਾਰੀ ਚਾਹੀਦੀ ਹੈ ਅਤੇ ਤੁਹਾਡੇ ਇਸ ਜ਼ਿਲ੍ਹੇ ਦੇ ਵਿੱਚ ਕੀ ਨਵਾਂ ਡਿਵੈਲਪਮੈਂਟ ਦੇ ਕੀ ਕੀ ਪ੍ਰੋਗਰਾਮ ਚੱਲਦੇ ਪਏ ਨੇ ਜੀ ਜੀ ਜੀ ਬਿਲਕੁਲ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ ਜੀ ਜੀ ਜੀ ਜੀ ਠੀਕ ਹੈ ਜੀ ਬਹੁਤ ਵਧੀਆ ਹਾਂਜੀ ਜੀ ਇਸ ਲਈ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ ਹੋਰ ਬ ਬੀੜ ਪੂਰੇ ਜ਼ਿਲ੍ਹਾ ਕਿਉਂ ਕਵਰ ਕਰਨਾ ਜੀ ਅਸੀਂ ਜੀ ਜੀ ਜੀ ਬਿਲਕੁਲ ਠੀਕ ਹੈ ਜੀ ਜੀ ਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਅਤੇ ਹੋਰ ਦੱਸ ਸਕਦੇ ਕੋਈ ਇ ਇ ਇਸ ਜ਼ਿਲ੍ਹੇ ਦੇ ਵਿੱਚ ਕੋਈ ਇੱਦਾਂ ਦਾ ਪਿੰਡ ਹੋਵੇ ਜਿੱਥੇ ਵ ਡਿਵੈਲਪਮੈਂਟ ਦਾ ਮੋਡਲ ਪੇਸ਼ ਕੀਤਾ ਹੋਵੇ ਅਸੀਂ ਉਹਨੂੰ ਕਵਰ ਕਰ ਸਕਦੇ ਹੋਈਏ ਜੀ ਜੀ ਜੀ ਜੀ ਜੀ ਜੀ ਜੀ ਹਾਂ ਠੀਕ ਹੈ ਜੀ ਕੋਈ ਨਾ ਆਪਾਂ ਜਲਦੀ ਹੀ ਇਸ ਤਰ੍ਹਾਂ ਦੇ ਹੋਰ ਵੀ ਡਿਵੈਲਪਮੈਂਟ ਦੇ ਕੰਮ ਤੁਹਾਡੇ ਜ਼ਿਲ੍ਹੇ 'ਚ ਹੋਏ ਤਾਂ ਉਹ ਸਾਨੂੰ ਦੱਸ ਦੇਣਾ ਹਾਂ ਕੋਸ਼ਿਸ਼ ਕਰਦਾ ਮੈਂ ਹੁਣ ਤੁਹਾਡੇ ਨਾਲ ਗੱਲ ਹੋ ਗਈ ਤਾਂ ਮੈਂ ਆਪਣੀ ਜਿਹੜੀ ਪੂਰੀ ਟੀਮ ਨਾਲ ਗੱਲ ਕਰਾਂਗਾ ਕਦੋਂ ਅਸੀਂ ਤੁਹਾਡੇ ਇੱਥੇ ਆ ਸਕਦੇ ਹਾਂ ਤੁਹਾਨੂੰ ਫਿਰ ਆਪਾਂ ਡੇਟ ਦੱਸ ਦੇਵਾਂਗੇ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਅਤੇ ਹੋਰ ਵੀ ਤੁਹਾਡੀ ਹੈਲਪ ਦੀ ਜਿਹੜੀ ਲੋੜ ਹੋਈ ਤਾਂ ਜ਼ਰੂਰ ਲਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ ਥੈਂਕ ਯੂ ਸਰ